ਮੇਰੇ ਕੋਲ ਕ ਕਈ ਤਰ੍ਹਾਂ ਦੇ ਵਿਸ਼ੇਸ਼ ਹੁਨਰ ਹਨ ਜਿਵੇਂ ਕਿ ਟਰੈਵਲਿੰਗ ਰੀਡਿੰਗ ਐਂਡ ਫੋਟੋਆਂ ਖਿੱਚਣੀਆਂ ਫੋਟੋਗ੍ਰਾਫ਼ੀ ਅਤੇ ਇਹ ਫੋਟੋਗ੍ਰਾਫ਼ੀ ਜਿਹੜਾ ਮੇਰਾ ਇੱਕ ਮੇਨ ਹੁਨਰ ਹੈਗਾ ਆ ਅਤੇ ਮੈਂ ਫੋਟੋਗ੍ਰਾਫ਼ੀ ਮੈਨੂੰ ਬਹੁਤ ਚੰਗੀ ਲੱਗਦੀ ਹੈ ਜਦੋਂ ਮੈਂ ਫੋਟੋਗ੍ਰਾਫ਼ੀ ਮੈਨੂੰ ਕਰਨੀ ਬਹੁਤ ਚੰਗੀ ਲੱਗਦੀ ਆ ਕਿਉਂਕਿ ਮੈਨੂੰ ਘੁੰਮਣ ਦਾ ਵੀ ਬੜਾ ਸ਼ੌਕ ਹੈ ਜਦੋਂ ਪਹਾੜਾਂ 'ਤੇ ਜਾਈਦਾ ਆ ਆਪਣੇ ਦੋਸਤਾਂ ਮਿੱਤਰਾਂ ਨਾਲ਼ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਨਾਲ਼ ਜਾਂ ਫੈਮਲੀ ਨਾਲ਼ ਜਾਈਦਾ ਆ ਕਿਸੇ ਧਾਰਮਿਕ ਸਥਾਨ 'ਤੇ ਉੱਥੇ ਵੀ ਮੈਨੂੰ ਫੋਟੋਆਂ ਖਿੱਚਣੀਆਂ ਆਪਣੀਆਂ ਆਪਣੇ ਰਿਸ਼ਤੇਦਾਰਾਂ ਦੀਆਂ ਅਤੇ ਉੱਥੇ ਦੀਆਂ ਜੋ ਹਿਸਟੋਰੀਕਲ ਬਿਲਡਿੰਗਾਂ ਹੈਗੀਆਂ ਉਹਦੀਆਂ ਫੋਟੋਆਂ ਖਿੱਚਣੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਹਨ